ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਜਦੋਂ ਲੋਕ ਸੁਬਹਾ ਦੌੜਨ ਲਈ ਜਾਂਦੇ ਹਨ ਆਪਣੇ ਕੰਨਾਂ ਵਿੱਚ ਹੈਡਫੋਨ ਲਾ ਲੈਂਦੇ ਹਨ ਉਹ ਕੋਈ ਗਾਣੇ ਸੁਣਦਾ ਕੋਈ ਕੁਝ ਸੁਣਦਾ ਪਰ ਮੈਂ ਆਪਣਾ ਮਨ ਇਹਨਾਂ ਗੱਲਾਂ ਵੱਲ ਨਹੀਂ ਲਾਉਂਦੀ ਮੇਰਾ ਮਨ ਸਿਰਫ ਪਰਮਾਤਮਾ ਦਾ ਨਾਮ ਜਪਣ ਵੱਲ ਹੀ ਰਹਿੰਦਾ ਜਦੋਂ ਮੈਂ ਸੁਬਹਾ ਜਲਦੀ ਉੱਠਦੀ ਹੈ ਅਤੇ ਆਪਣੇ ਘਰ ਵਿੱਚ ਸ ਸੁਬਹਾ ਉੱਠ ਕੇ ਪਰਮਾਤਮਾ ਦਾ ਨਾਮ ਜਪਿ ਕੇ ਫਿਰ ਮੈਂ ਸੈਰ ਨੂੰ ਜਾਨੀ ਹੈ ਅਤੇ ਮੈਂ ਆਪਣਾ ਹਜੇ ਪਰਮਾਤਮਾ ਦਾ ਨਾਮ ਜਪਦੀ ਜਪਦੀ ਐਕਸਰਸਾਈਜ਼ ਕਰਨ ਲਈ ਤੁਰੀ ਜਾਨੀ ਹੈ ਫਿਰ ਮੈਂ ਐਕਸਰਸਾਈਜ਼ ਕਰਦੀ ਕਰਦੀ ਵੀ ਪਰਮਾਤਮਾ ਦਾ ਨਾਮ ਜ ਜਪਦੀ ਹੈ ਪਰ ਮੈਂ ਇਹਨਾਂ ਗੱਲਾਂ ਨੂੰ ਨਹੀਂ ਸਮਝਦੀ ਮੈਂ ਹਮੇਸ਼ਾ ਐਕਸਰਸਾਈਜ਼ ਕਰਨ ਵੇਲੇ ਪਰਮਾਤਮਾ ਦਾ ਨਾਮ ਜਪਦੀ ਹੈ ਅਤੇ ਗੁਰਦੁਆਰਾ ਸਾਹਿਬ ਜਾਨੀ ਹੈ ਅਤੇ ਉੱਥੇ ਕਈ ਲੋਕ ਮੈਨੂੰ ਮਿਲਦੇ ਹਨ ਅਸੀਂ ਸਾਰੇ ਰਲ ਮਿਲ ਕੇ ਐਕਸਰਸਾਈਜ ਕਰਦੇ ਹੈ ਅਤੇ ਪਰਮਾਤਮਾ ਦਾ ਨਾਮ ਜਪਦੇ ਆ ਪਰ ਕੋਈ ਵੀ ਇਹੋ ਜਿਹਾ ਨਹੀਂ ਹੈ ਜੋ ਪਰਮਾਤਮਾ ਦਾ ਨਾਮ ਨਹੀਂ ਜਪਦਾ ਉੱਥੇ ਸਭ ਪਰਮਾਤਮਾ ਦਾ ਨਾਮ ਜਪਦੇ ਆ ਅਸੀਂ ਸਾਰੇ ਐਕਸਰਸਾਈਜ਼ ਕਰਦੇ ਹਾਂ ਅਤੇ ਐਕਸਰਸਾਈਜ਼ ਕਰਕੇ ਫਿਰ ਅੱਧਾ ਘੰਟਾ ਬਾਅਦ ਅਸੀਂ ਪਰਮਾਤਮਾ ਦਾ ਨਾਮ ਲੈ ਜਪ ਕੇ ਆਪਣੇ ਆਪਣੇ ਘਰਾਂ ਨੂੰ ਤੁਰ ਪੈਨੇ ਆ ਅਤੇ ਆਉਂਦੇ ਆਉਂਦੇ ਰਾਸਤੇ ਵਿੱਚ ਵੀ ਪਰਮਾਤਮਾ ਦਾ ਨਾਮ ਜਪਦੇ ਆ ਫਿਰ ਘਰੇ ਆ ਕੇ ਅਸੀਂ ਆਪਣਾ ਕੰਮ ਕਾਰ ਸ਼ੁਰੂ ਕਰ ਦਿੰਦੇ ਹਾਂ ਉਦੂ ਬਾਅਦ ਦੁਪਹਿਰ ਹੋ ਜਾਂਦੀ ਹੈ ਅਤੇ ਫਿਰ ਉਦੂ ਬਾਅਦ ਸ਼ਾਮ ਦੇ ਟਾਈਮ 'ਤੇ ਅਸੀਂ ਫਿਰ ਵਾਹਿਗੁਰੂ ਦੇ ਘਰ ਜਾਨੇ ਹਾਂ ਉਦੂ ਬਾਅਦ ਵਾਹਿਗੁਰੂ ਦੇ ਘਰੇ ਜਾ ਕੇ ਐਕਸਰਸਾਈਜ਼ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਹਨ ਅਸੀਂ ਸਾਰੇ ਹੀ ਵਾਹਿਗੁਰੂ ਦੇ ਘਰੇ ਐਕਸਰਸਾਈਜ਼ ਦੀਆਂ ਅਤੇ ਐਕਸਰਸਾਈਜ਼ ਕਰਦੀਆਂ ਅਤੇ ਫਿਰ ਸਾਨੂੰ ਅ ਐਕਸਰਸਾਈਜ ਤੋਂ ਬਾਅਦ ਅਸੀਂ ਅੱਧਾ ਘੰਟਾ ਲਾ ਕੇ ਅਸੀਂ ਆਪਣੇ ਆਪਣੋ ਘਰੀਂ ਪਹੁੰਚ ਜਾਂਦੀਆਂ ਹਨ ਅਤੇ ਵਾਹਿਗੁਰੂ ਦਾ ਨਾਮ ਜਪਦੀਆਂ ਆਉਂਦੀਆਂ ਹਨ